ਹੈਲੋ ਦਿਲਪ੍ਰੀਤ ਬੋਲਦਾ ਵੀਰੇ ਵੀਰੇ ਤੁਹਾਡਾ ਨੰਬਰ ਲਿਆ ਸੀਗਾ ਆਕਾਸ਼ ਤੋਂ ਅਤੇ ਵੀਰੇ ਮੈਂ ਨਾ ਇਥੇ ਹੌਸ ਕਾਲਜ 'ਚ ਨਿਊ ਐਡਮਿਸ਼ਨ ਲਈ ਆ ਅਤੇ ਮੈਨੂੰ ਨਾ ਮਤਲਬ ਪੀ ਜੀ ਚਾਹੀਦਾ ਸੀਗਾ ਰਹਿਣ ਨੂੰ ਜਗ੍ਹਾ ਨਹੀਂ ਹੈਗੀ ਕੋਈ ਅਤੇ ਮੈਂ ਮਤਲਬ ਬਹੁਤ ਦੂਰ ਤੋਂ ਆਉਂਦਾ ਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਅਤੇ ਹੁਣ ਬਈ ਮੈਂ ਤਾਂ ਆਉਂਦਾ ਵੀ ਬੜੀ ਦੂਰੋਂ ਹਾਂ ਅਤੇ ਮਤਲਬ ਰੋਜ਼ ਅਪ ਡਾਊਨ ਵੀ ਨਹੀਂ ਕਰ ਸਕਦਾ ਹੈਗਾ ਹਾਂਜੀ ਤੇ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਆ ਤੁਹਾਨੂੰ ਪਤਾ ਹੀ ਆ ਭਾਅ ਜੀ ਜੇ ਹੁਣ ਰਹਾਂਗੇ ਤਾਂ ਰੋਟੀ ਪਾਣੀ ਵੀ ਖਾਣਾ ਪੈਣਾ ਵਾ ਕੱਪੜਿਆਂ ਦਾ ਵੀ ਤੁਹਾਨੂੰ ਪਤਾ ਕੱਪੜੇ ਵੀ ਧੋਣੇ ਧੋਣੇ ਹੁੰਦੇ ਆ ਅਤੇ ਪੜ੍ਹਾਈ ਦੇ ਨਾਲ ਨਾਲ ਫਿਰ ਇੰਨਾ ਕੁਝ ਆਪ ਤਾਂ ਕਰ ਨਹੀਂ ਸਕਦੇ ਆਪਾਂ ਹਾਂਜੀ ਹਾਂਜੀ ਪੇਪਰ ਵੀ ਆ ਗਏ ਹਾਂਜੀ ਅੱਛਾ ਜੀ ਹਾਂਜੀ ਨਹੀਂ ਉਹ ਤਾਂ ਫਿਰ ਵੀ ਵੀਰ ਜੀ ਉਹ ਹੋਸਟਲ ਦਾ ਹੀ ਸੀਗਾ ਜ਼ਿਆਦਾ ਪੀ ਜੀ ਦਾ ਹੀ ਕਿਵੇਂ ਕਿਉਂਕਿ ਨਾ ਬਾਈ ਜੀ ਅ ਰੋਜ਼ ਅਪ ਡਾਊਨ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਅਤੇ ਬਾਅਦ 'ਚ ਤੁਹਾਨੂੰ ਪਤਾ ਹੀ ਆ ਪੜ੍ਹਨਾ ਵੀ ਹੁੰਦਾ ਹੈ ਅਤੇ ਬੰਦੇ ਨੇ ਸਿਰ ਦਰਦ ਕਰਨ ਲੱਗ ਪੈਂਦਾ ਅਪ ਡਾਊਨ ਕਰਕੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਾਈ ਹਾਂਜੀ ਹਾਂਜੀ ਹਾਂਜੀ ਬਾਈ ਜੀ ਹਾਂਜੀ ਜ਼ਰੂਰ ਦੇਖਿਓ ਬਾਈ ਜੀ ਕਿਉਂਕਿ ਨਾ ਹੁਣ ਇੱਕ ਦੋ ਦਿਨ ਤਾਂ ਮੈਂ ਅਪ ਡਾਊਨ ਸਕਦਾ ਕਿਉਂਕਿ ਜ਼ਿਆਦਾ ਦਿਨ ਫਿਰ ਐਡਜਸਟ ਵੀ ਨਾ ਹੋਣਾ ਅਪ ਡਾਊਨ ਹਾਂਜੀ ਤੁਹਾਨੂੰ ਪਤਾ ਹੀ ਆ ਕਿਰਾਇਆ ਬਹੁਤ ਲੱਗਦਾ ਹੈ ਜੀ ਠੀਕ ਹੈ ਵੀਰੇ ਓਕੇ ਜੀ